ਅਸੀਂ ਆਪਣੇ ਗੀਤਾਂ ਦੀ ਚੋਣ ਜ਼ਿਆਦਾਤਰ ਔਨਲਾਇਨ ਦੇ ਮਾਧਿਅਮ ਦੇ ਰਾਹੀਂ ਕਰਦੇ ਹਾਂ ਜੋ ਅਸੀਂ ਪੇਸ਼ ਕਰਦੇ ਹਾਂ ਕਈ ਵਾਰ ਅਸੀਂ ਆਪਣੇ ਮੋਬਾਇਲ ਫ਼ੋਨ ਵਿੱਚ ਵੀ ਆਪਣੇ ਗੀਤਾਂ ਦੀ ਚੋਣ ਕਰਦੇ ਹਾਂ ਉਸ ਵਿੱਚੋਂ ਪਤਾ ਚੱਲ ਜਾਂਦਾ ਹੈ ਕਿ ਅਸੀਂ ਕਿਵੇਂ ਦਾ ਗਾਣਾ ਪੇਸ਼ ਕਰਨਾ ਹੈ ਤਾਂ ਜੋ ਅਸੀਂ ਉਸ ਰਾਹੀਂ ਆਪਣੇ ਗੀਤਾਂ ਦੀ ਚੋਣ ਕਰ ਸਕੀਏ